ਪੰਜਾਬ ਦੇ ਵਿੱਚ ਜਿਹੜਾ ਕਾਰੋਬਾਰ ਹੈਗੇ ਆ ਉਹਨਾਂ ਨੂੰ ਆਪਾਂ ਬਿਹਤਰ ਬਣਾਉਣ ਲਈ ਜਿੱਦਾਂ ਕਿ ਆਪਾਂ ਅੱਜ ਕੱਲ੍ਹ ਸੁਣਦੇ ਹਾਂ ਜਿੱਦਾਂ ਆਪਣੇ ਸਭ ਤੋਂ ਪਹਿਲਾਂ ਆਪਾਂ ਆਪਣੀ ਪ੍ਰਮੋਸ਼ਨ ਕਰਾ ਸਕਦੇ ਹਾਂ ਥਰੋ ਡੀ ਡਿਜਟਲ ਮੀਡੀਆ ਦੇ ਥਰੂ ਜਿੱਦਾਂ ਫੈਸਬੁੱਕ ਇੰਸਟਾਗ੍ਰਾਮ 'ਤੇ ਆਪਾਂ ਪੋਸਟ ਲਗਾ ਕੇ ਆਪਣੇ ਪ੍ਰੋਡਕਟ ਨੂੰ ਲੋਕਾਂ ਰਾਹੀਂ ਭੇ ਦਿਖਾ ਸਕਦੇ ਹਾਂ ਆਪਣੀ ਆਹ ਇੱਕ ਖੂਬਸੂਰਤ ਦੀ ਵੈਬਸਾਈਟ ਡਿਜ਼ਾਇਨ ਕਰਕੇ ਆਪਣੇ ਸਾਰੇ ਉਹਦੇ ਵਿੱਚ ਇਨਫੋਰਮੇਸ਼ਨ ਪਾ ਕੇ ਸਭ ਕੁਝ ਆਪਾਂ ਕਰ ਸਕਦੇ ਹਾਂ ਜੇਕਰ ਤੁਹਾਡੇ ਕੋਲ ਕੋਈ ਇਹੋ ਜਿਹਾ ਪ੍ਰੋਡਕਟ ਹੈ ਜਿਹੜਾ ਤੁਸੀਂ ਆਨਲਾਈਨ ਲੋਕਾਂ ਨੂੰ ਵੇਚ ਸਕਦੇ ਹੋ ਅਤੇ ਤੁਸੀਂ ਇੱਕ ਆਪਣਾ ਈ ਕਮਰਸ ਪਲੈਟਫੋਮ ਬਣਾ ਕੇ ਉਹਦੇ ਵਿੱਚ ਲੋਕ ਤੁਹਾਡੇ ਜਿਹੜੇ ਪ੍ਰੋਡਕਟਸ ਹੈਗੇ ਆ ਉਹ ਤੁਹਾਡੀ ਵੈੱਬਸਾਈਟ ਦੇ ਉੱਤੇ ਆ ਕੇ ਬਾਏ ਕਰ ਸਕਦੇ ਹਨ ਜਿਹਦੇ ਨਾਲ ਕੀ ਹੋਏਗਾ ਕਿ ਲੋਕ ਘਰ ਬੈਠੇ ਤੁਹਾਡਾ ਇਹ ਪ੍ਰੋਡਕਟਸ ਉਹਨਾਂ ਦੇ ਕੋਲ ਡਿਲੀਵਰ ਹੋ ਜਾਣਗੇ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਚੰਗੀ ਚੀਜ਼ ਹੈ ਜਿਹਦੇ ਕਰਕੇ ਕੀ ਤ ਤੁਹਾਡਾ ਜਿਹੜਾ ਬਿਜ਼ਨਸ ਹੈਗਾ ਵੈ ਜਿਹੜਾ ਤੁਹਾਡਾ ਕਾਰੋਬਾਰ ਹੈ ਉਹ ਵਿਦੇਸ਼ਾਂ ਵਿੱਚ ਵੀ ਜਾ ਸਕਦਾ ਹੈ ਸੋ ਤੁਹਾਨੂੰ ਜੋ ਹੈਗਾ ਹੈ ਇਹ ਚੀਜ਼ ਅਪਣਾਉਣੀ ਚਾਹੀਦੀ ਹੈ ਕਿ ਜਿਹੜਾ ਤੁਹਾਡਾ ਬਿਜ਼ਨਸ ਹੈ ਤੁਸੀਂ ਉਹਨੂੰ ਪ੍ਰੋਪਰ ਇੱਕ ਟਰੈਕ ਦੇ ਵਿੱਚ ਰੱਖੋ ਜਿੰਨਾ ਤੁਸੀਂ ਕਮਾਉਂਦੇ ਹੈਗੇ ਹੋ ਘੱਟੋ ਘੱਟ ਉਹਦਾ ਪੰਦਰ੍ਹਾਂ ਤੋਂ ਵੀਹ ਪ੍ਰਸੈਂਟ ਜਿਹੜਾ ਹੈ ਤੁਸੀਂ ਆਪਣੇ ਇਨਵੈਸਟਮੈਂਟ ਜਿਹੜੀ ਹੈ ਉਹ ਆਪਣੇ ਡਿਜੀਟਲ ਪਲੈਟਫਾਰਮ ਦੇ ਉੱਤੇ ਕਰੋ ਜਿੱਦਾਂ ਕਿ ਵੈੱਬਸਾਈਟ ਦੇ ਵਿੱਚ ਪ੍ਰਮੋਸ਼ਨਸ ਵਿੱਚ ਐਸਸੀਓ ਦੇ ਵਿੱਚ ਜਿਹਦੇ ਕਰਕੇ ਕੀ ਹੈ ਤੁਹਾਨੂੰ ਬਿਹਤਰ ਤੋਂ ਬਿਹਤਰ ਵਧੀਆ ਤੋਂ ਵਧੀਆ ਲੀਡ ਮਿਲ ਸਕੇ ਜੇ ਤੁਹਾਡਾ ਕੋਈ ਵੀ ਦੋ ਤਿੰਨ ਲੀਡ ਵਧੀਆ ਆ ਗਈ ਉਹਦੇ ਨਾਲ ਕੀ ਹੈ ਤੁਹਾਡਾ ਬਿਜ਼ਨਸ ਜਿਹੜਾ ਹੈ ਉਹ ਹੋਰ ਚੰਗਾ ਵਧੀਆ ਗਰੋ ਹੋ ਸਕਦਾ ਹੈ ਸੋ ਇਹ ਮੇਰੇ ਰਾਏ ਹੈਗਾ ਕਿ ਤੁਸੀਂ ਪੰਜਾਬ ਦੇ ਵਿੱਚ ਇੱਦਾਂ ਆਪਣਾ ਬਿਜ਼ਨਸ ਗਰੋ ਕਰ ਸਕਦੇ ਹੋ